ਹਾਂਜੀ ਮੈਂ ਸੋਨੀ ਟੀ ਵੀ ਉੱਤੇ ਚੱਲ ਰਹੇ ਚੱਲਦੇ ਇੰਡੀਅਨ ਆਈਡਲ ਵਰਗੇ ਸੰਗੀਤ ਰਿਆਲਟੀ ਸ਼ੋ ਜ਼ਰੂਰ ਦੇਖਦਾ ਹਾਂ ਮੇਰੇ ਜਿਹੜੇ ਰਿਆਲਟੀ ਸ਼ੋ ਦੇ ਕ ਕੰਟੈਸਟ ਸੀਗੇ ਉਹ ਨੇਹਾ ਕੱਕੜ ਜੀ ਸੀਗੇ ਅਤੇ ਮੈਂ ਉਹਨਾਂ ਨੂੰ ਦੇਖ ਕੇ ਬਹੁਤ ਗਾਉਣਾ ਸਿੱਖਿਆ ਅਤੇ ਉਹ ਅੱਜ ਇਸ ਮੁਕਾਮ 'ਤੇ ਹਨ ਕਿ ਚੰਗੇ ਸਿੰਗਰ ਨੇ ਅਤੇ ਉਹਨਾਂ ਦੇ ਬਹੁਤ ਸਾਰੇ ਜਿਹੜੇ ਐਲਬਮ ਨੇ ਉਹ ਆ ਚੁੱਕੇ ਨੇਗੇ ਅਤੇ ਮੈਨੂੰ ਉਹ ਬਹੁਤ ਚੰਗੇ ਲੱਗਦੇ ਹਨ ਮੈਂ ਉਹਨਾਂ ਤੋਂ ਉਹਨਾਂ ਨੂੰ ਦੇਖ ਕੇ ਹੀ ਗਾਉਣਾ ਸਿੱਖ ਰਿਹਾ ਹਾਂ ਧੰਨਵਾਦ